ਉਹ ਤਸਵੀਰਾਂ ਯਾਤਰਾ ਯਾਤਰਾ ਤਾਂ ਬਹੁਤ ਕੀਤੀਆਂ ਕਦੇ ਯਾਤਰਾ 'ਤੇ ਚਲੇ ਗਏ ਕਦੀ ਕਿਤੇ ਚਲੇ ਗਏ ਕਦੇ ਕਿਤੇ ਚਲੇ ਗਏ ਉੱਥੇ ਜਾ ਕੇ ਵੀਡੀਓ ਵਾਡੀਓ ਬਣਾ ਲਈ ਦੀ ਹੈ ਅਤੇ ਹੁਣ ਅਸੀਂ ਇੱਧਰ ਕਦੇ ਇੱਧਰ ਜਾ ਕੇ ਆਏ ਹਾਂ ਅਸੀਂ ਮਨਾਲੀ ਵੱਲ ਉੱਧਰ ਬਰਫ ਪਈ ਹੋਈ ਸੀ ਉੱਥੇ ਵੀਡੀਓ ਬਣਾਈ ਬਹੁਤ ਵਧੀਆ ਪਿੱਛੇ ਲੋਕੇਸ਼ਨ ਬਹੁਤ ਵਧੀਆ ਬਣੀ ਸੀ ਲੋਕੇਸ਼ਨ ਐਨ ਪੂਰੀ ਓਕੇ ਆ ਜੀ ਐਨ ਪੂਰੇ ਓਕੇ ਹਿਸਾਬ ਨਾਲ ਵੀਡੀਓ ਬਣਾਈ ਐਨ ਵਧੀਆ ਤਰੀਕੇ ਨਾਲ ਵੀਡੀਓ ਬਣੀ ਹੈ ਐਨ ਪਿੱਛੋਂ ਲੋ ਪਿੱਛੋਂ ਲੁੱਕ ਵੀ ਵਧੀਆ ਆਈ ਸੀ ਉਹਦੀ